ਹੈਲੋ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਜੀ ਸਵੇਰੇ ਪੰਜ ਹਜ਼ਾਰ ਫ਼ੀਸ ਹੈ ਸਵੇਰ ਦੀ ਅਲਗ ਹੈ ਅਤੇ ਸ਼ਾਮ ਦੀ ਅਲਗ ਹੈ ਤੁਸੀਂ ਕਿਹੜੇ ਕਰਨੀ ਹੈ ਸ਼ਾਮ ਦੀ ਤੋ ਛੇ ਹਜ਼ਾਰ ਲੱਗਨੀ ਹੈ ਤੋ ਤੁਸੀਂ ਕਿੰਨਾਂ ਦੇਣਾ ਚਾਹੁੰਦੇ ਓ ਚਲੋ ਕੋਈ ਗੱਲ ਨੀ ਅਸੀਂ ਤੋਹਾਨੂੰ ਕਰ ਦੇਵਾਂਗਾ ਕਿਉਂਕਿ ਤੋਹਾਨੂੰ ਤੁਸੀਂ ਕਿਸੇ ਤੋਂ ਪੁੱਛ ਕੇ ਆਏ ਓ ਨਾ ਸਾਡੇ ਕੋਲ ਕੋਈ ਗੱਲ ਨੀ ਕਰ ਦੇਣਾ ਅਸੀਂ ਹਾਂਜੀ ਹੋਰ ਕੁਛ ਪੁੱਛਣਾ ਹੋਉ ਤੁਹਾਨੂੰ ਹਾਂਜੀ ਹਾਂਜੀ ਉਹ 'ਚ ਬੈਨੀਫਿੱਟ ਬਹੁਤ ਹੋਣ ਹੋਣੀ ਹੈ ਯੋਗਾ ਦੀ ਤੁਸੀਂ ਏ ਤੁਸੀਂ ਬੈਨੀਫਿੱਟਸ ਜਿਸ ਤੁਸੀਂ ਲਓਗੇ ਤੋ ਬੈਨੀਫਿੱਟ ਹੋਣੇ ਹੈ ਐ ਤੁਸੀਂ ਸਿਹਤਮੰਦ ਰਹੋਗੇ ਯੋਗਾ ਕਰੋਗੇ ਤੋ ਔਰ ਹੋਰ ਤੁਸੀਂ ਦੱ ਜਿੰਨਾਂ ਤੁਸੀਂ ਰੱਖੋ ਸਿਕਸ ਮੰਨਥ ਜਾਂ ਫਿਰ ਤੀ ਤਿੰਨ ਮੰਨਥ ਥਰੀ ਮੰਨਥ ਨਹੀਂ ਨਹੀਂ ਉਹਨਾਂ ਦੀ ਫ਼ੀਸ ਤੋ ਉਨਾ ਹੀ ਹੋਣੀ ਹੈ ਫਿਕਸ ਹੈ ਸਿਕਸ ਥਾਊਸੈਂਟ ਫੌਰ ਥਾਊਸੈਂਟ ਅਤੇ ਫਾਈਵ ਥਾਊਸੈਂਟ ਕਿਹਾ ਤੁਸੀਂ ਫਾਈਵ ਥਾਊਸੈਂਟ ਹੈ ਉਹਨਾਂ ਦੀ ਫ਼ੀਸ

ਜੀ ਤੁਸੀਂ ਕਿੰਨਾਂ ਦੇਣਾ ਚਾਹੁੰਦੇ ਓ ਦੱਸ ਤਾ ਦਿਓ ਅੱਛਾ ਕੋਈ ਗੱਲ ਨੀ ਉਹਨਾਂ ਨੂੰ ਭੇਜ ਦਿਓ ਮੈਂ ਉਹਨਾਂ ਨੂੰ ਕਰ ਦਵਾਂਗੀ ਦੇਖਲੂਗੀ ਅੱਛਾ ਠੀਕ ਹੈ ਜੀ ਥੈਂਕ ਯੂ